ਚੰਗੀ ਫੀਡਬੈਕ ਮਿਲੀ ਹੈ ਕਿ ਮੈਂ ਕਈਆਂ ਨੂੰ ਤੋਹਫ਼ੇ ਵਿੱਚ ਹੱਥ ਨਾਲ ਸਿਲਾਈ ਕਰਕੇ ਕੱਪੜੇ ਦਿੱਤੇ ਹਨ ਅਤੇ ਉਹਨਾਂ ਨੇ ਮੇਰੀ ਕਾਫ਼ੀ ਤਾਰੀਫ ਕੀਤੀ ਹੈ ਕਿ ਤੁਹਾਡੇ ਕੱਪੜੇ ਅਸੀਂ ਲਏ ਹੋਏ ਬਹੁਤ ਵਧੀਆ ਡਿਜਾਇਨ ਹੁੰਦੇ ਹਨ ਅਤੇ ਇਸ ਕਰਕੇ ਮਤਲਬ ਕਿ ਲੋਕ ਬਹੁਤ ਪਸੰਦ ਕਰਦੇ ਹਨ ਮੈਂ ਜਿਹਨੂੰ ਵੀ ਸੀਅ ਕਿ ਗਿਫਟ ਦਿੱਤਾ ਹੈ ਕੱਪੜੇ ਦਾ ਅਤੇ ਵਧੀਆ ਤਰੀਕੇ ਨਾਲ ਰੈਡੀਮੇਟ ਤੋਂ ਵੀ ਵਧੀਆ ਤਰੀਕੇ ਨਾਲ ਸਿਲਾਈ ਕਰਕੇ ਮੈਂ ਜਿਹਨੂੰ ਵੀ ਦਿੱਤਾ ਹੈ ਤਾਂ ਉਹ ਬਹੁਤ ਤਾਰੀਫ ਕੀਤੀ ਹੈ ਉਹਨਾਂ ਨੇ ਕਿ ਅੱਗੇ ਤੋਂ ਤੁਸੀਂ ਸਾਨੂੰ ਬਣਾ ਕੇ ਦੇਣੇ ਹਨ ਕੱਪੜੇ ਅਤੇ ਇਸ ਕਰਕੇ ਹੱਥ ਦੇ ਸੀਤੇ ਹੋਏ ਕੱਪੜੇ ਕਈ ਵਾਰੀ ਜ਼ਿਆਦਾ ਲੋਕ ਪਸੰਦ ਕਰਦੇ ਹਨ ਕਿ ਇਹ ਵਧੀਆ ਡਿਜ਼ਾਇਨ ਹੱਥ ਨਾਲ ਬਣਾਏ ਜਾਂਦੇ ਹਨ ਅਤੇ ਕਈ ਵਾਰੀ ਰੈਡੀਮੇਡ ਵਿੱਚ ਓਨਾ ਨਹੀਂ ਹੁੰਦਾ ਹੈ ਅਤੇ ਇਸ ਲਈ ਹੱਥ ਨਾਲ ਅਸੀਂ ਕਿਸੇ ਤਰ੍ਹਾਂ ਦਾ ਵੀ ਕੱਪੜਾ ਵਧੀਆ ਤੋਂ ਵਧੀਆ ਤਿਆਰ ਕਰ ਸਕਦੇ ਹਨ ਕਾਫ਼ੀ ਤਾਰੀਫ ਮਿਲੀ ਹੈ